ਸੱਤ ਮਾਰਚ ਉੱਨੀ ਸੌ ਸਤਾਨਵੇਂ ਬਾਰ੍ਹਾਂ ਸਤੰਬਰ ਉੱਨੀ ਸੌ ਚੁਰਾਨਵੇਂ ਪੰਦਰ੍ਹਾਂ ਅਗਸਤ ਉੱਨੀ ਸੌ ਨੜੇਨਵੇਂ ਬਾਰ੍ਹਾਂ ਜਨਵਰੀ ਉੱਨੀ ਸੌ ਅਠਾਨਵੇਂ ਪੰਜ ਦਸੰਬਰ ਦੋ ਹਜ਼ਾਰ ਇੱਕ